ਹਾਂਜੀ ਮੈਂ ਇੱਕ ਵਾਰ ਗਈ ਸੀ ਨੈਣਾਂ ਦੇਵੀ ਅਤੇ ਮੈਨੂੰ ਇਸ ਥਾਂ 'ਤੇ ਘੁੰਮ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਅਤੇ ਇਸ ਤੋਂ ਪਹਿਲਾਂ ਮੈਂ ਬਹੁਤ ਛੋਟੇ ਹੁੰਦੇ ਗਏ ਸੀ ਅਤੇ ਉਸ ਟਾਈਮ ਦਾ ਤਾਂ ਮੈਨੂੰ ਇੰਨਾਂ ਜ਼ਿਆਦਾ ਚੇਤੇ ਵੀ ਨਹੀਂ ਸੀ ਪਰ ਜਦੋਂ ਮੈਂ ਦੁਬਾਰਾ ਇਸ ਜਗ੍ਹਾ 'ਤੇ ਘੁੰਮ ਕੇ ਆਈ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸਭ ਤੋਂ ਪਹਿਲਾਂ ਅਸੀਂ ਮਾਤਾ ਦੇਵੀ ਦੇ ਦਰਸ਼ਨ ਕੀਤੇ ਅਤੇ ਜਦੋਂ ਅਸੀਂ ਗਏ ਸੀ ਉਸ ਟਾਈਮ ਇੰਨੇ ਜ਼ਿਆਦਾ ਭੀੜ ਨਹੀਂ ਸੀ ਅਤੇ ਬਹੁਤ ਈਜ਼ੀਲੀ ਸਾਡੇ ਦਰਸ਼ਨ ਹੋ ਗਏ ਸੀ ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਥਾਵਾਂ 'ਤੇ ਘੁੰਮੇ ਉੱਥੇ ਦਾ ਦ੍ਰਿਸ਼ ਦੇਖਿਆ ਅਤੇ ਉਹ ਠੰਡਾ ਇਲਾਕਾ ਹੋਣ ਕਰਕੇ ਉਥੋਂ ਦਾ ਏਰੀਆ ਬਹੁਤ ਜਿਆਦਾ ਵਧੀਆ ਸੀ ਅਤੇ ਉੱਥੇ ਚੜ੍ਹਾਈ ਚੜ੍ਹ ਕੇ ਮਾਤਾ ਦੇ ਦਰਸ਼ਨ ਕੀਤੇ ਉਹ ਦੇਸ਼ ਸਾਨੂੰ ਬਹੁਤ ਵਧੀਆ ਲੱਗਿਆ ਉੱਥੋਂ ਦੀਆਂ ਦੁਕਾਨਾਂ ਉੱਥੋਂ ਦੇ ਦ੍ਰਿਸ਼ ਬਹੁਤ ਜ਼ਿਆਦਾ ਵਧੀਆ ਸੀ ਪਰ ਉੱਥੇ ਇੱਕ ਘਟਨਾ ਵਾਪਰ ਗਈ ਸੀ ਕਿ ਜਦੋਂ ਅਸੀਂ ਵਾਪਸ ਆਉਣਾ ਸੀ ਤਾਂ ਸਾਨੂੰ ਪਰਸਨ ਨੇ ਗਲਤ ਗਾਈਡ ਕਰ ਦਿੱਤਾ ਅਤੇ ਸਾਡੇ ਰਸਤਾ ਬਹੁਤ ਜ਼ਿਆਦਾ ਲੰਬਾ ਪੈ ਗਿਆ ਸੀ ਅਤੇ ਸਾਨੂੰ ਉਹ ਨੈਨਾ ਦੇਵੀ ਦਾ ਰਸਤਾ ਪੂਰਾ ਨੰਗਲ ਡੈਮ ਤੋਂ ਹੋ ਗਏ ਨੰਗਲ ਦੇ ਉੱਪਰੋਂ ਘੁੰਮ ਕੇ ਆਉਣਾ ਪਿਆ ਜਦ ਕਿ ਸਾਡੀਆਂ ਅਨੰਦਪੁਰ ਵੱਲ ਤਾਂ ਅਠਾਰ੍ਹਾਂ ਕਿਲੋਮੀਟਰ ਦਾ ਰਸਤਾ ਪੈਂਦਾ ਸੀ ਜੋ ਕਿ ਅਸੀਂ ਅੱਧੇ ਘੰਟੇ ਦੇ ਘੱਟ ਸਮੇਂ ਦੇ ਵਿੱਚ ਹੀ ਕਵਰ ਕਰ ਦੇਣਾ ਸੀ ਪਰ ਇਸ ਚੀਜ਼ ਨੇ ਉਸ ਚੀਜ਼ ਨੂੰ ਬਹੁਤ ਜ਼ਿਆਦਾ ਮਤਲਬ ਅਕਰਸ਼ਿਤਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਮਤਲਬ ਬਹੁਤ ਜ਼ਿਆਦਾ ਔਡ ਬਣਾ ਦਿੱਤਾ ਸੀ ਅਤੇ ਇਹ ਚੀਜ਼ ਕਰਕੇ ਮੈਂ ਉਹ ਸਿਰਫ ਆਪਣਾ ਸਫਰ ਹੈ ਕਦੇ ਨਹੀਂ ਭੁੱਲਦੀ